ਇਕ ਲੱਖ ਸਵਾ ਲੱਖ ਦੋ ਲੱਖ ਛੱਬੀ ਹਜ਼ਾਰ ਪੰਜ ਸੌ ਅੱਸੀ ਇੱਕ ਲੱਖ ਤੀਹ ਹਜ਼ਾਰ ਸੱਤ ਸੌ ਅੱਠ ਲੱਖ ਪੰਜਾਹ ਹਜ਼ਾਰ ਤਿੰਨ ਸੌ ਇੱਕ ਲੱਖ ਪਝੱਤਰ ਹਜ਼ਾਰ ਪੰਜ ਸੌ ਅੱਸੀ